ਸਤਿ ਸ਼੍ਰੀ ਅਕਾਲ ਸਰ ਮੈਂ ਮੀਨਾਕਸ਼ੀ ਪਠਾਨਕੋਟ ਤੋਂ ਬੋਲ ਰਹੀ ਹਾਂ ਅਤੇ ਸਾਡੇ ਸਾਡੇ ਘਰ ਵਿੱਚ ਹੀ ਇੱਕ ਨਿੱਕੀ ਜਿਹੀ ਫਾਰਮ ਹੈ ਜੋ ਕਿ ਮੇਰੇ ਪਿਤਾ ਜੀ ਨੇ ਬਣਾਈ ਹੋਈ ਹੈ ਜਿਸ ਵਿੱਚ ਅਸੀਂ ਖੇਤੀਬਾੜੀ ਕਰਦੇ ਹਾਂ ਅਤੇ ਜ਼ਿਆਦਾ ਤੋਂ ਜ਼ਿਆਦਾ ਸਮਾਂ ਬਿਤਾਉਂਦੇ ਹਾਂ ਅਤੇ ਘਰ ਦੇ ਹੋਰ ਵੀ ਮੈਂਬਰ ਇਸ ਵਿੱਚ ਕਈ ਵਾਰ ਖੇਤੀਬਾੜੀ ਕਰ ਲੈਂਦੇ ਹਨ ਜਿਸ ਵਿੱਚ ਅਸੀਂ ਬਹੁਤ ਕਈ ਵਾਰ ਫਸਲ ਲਗਾਉਂਦੇ ਹਾਂ ਅਤੇ ਕਈ ਵਾਰ ਸੀਜ਼ਨ ਦੇ ਸੀਜ਼ਨ ਸਬਜ਼ੀਆਂ ਉਗਾਉਂਦੇ ਹਾਂ ਜਿਵੇਂ ਕਿ ਇਸ ਗਰਮੀ ਦੇ ਸੀਜ਼ਨ ਵਿੱਚ ਅਸੀਂ ਭਿੰਡੀਆ ਕੱਦੂ ਖੀਰੇ ਤਾ ਸ ਤਾਜ਼ੀਆਂ ਸਬਜ਼ੀਆਂ ਆਦਿ ਉਗਾਈਆਂ ਹਨ ਅਤੇ ਕਈ ਵਾਰ ਫਸਲ ਵੀ ਬੀਜ਼ ਲਈ ਫਸਲ ਵੀ ਬੀਜ਼ੀ ਬੀਜ਼ ਲਈ ਦੀ ਹੈ ਜਿਵੇਂ ਅਤੇ ਹੋਰ ਆਦਿ ਖੇਤੀਬਾੜੀ ਕਰ ਲਈ ਦੀ ਹੈ ਅਤੇ ਖੇਤੀਬਾੜੀ ਕਰਨ ਨਾਲ ਸਾਡੇ ਸਰੀਰ ਸਰੀਰ ਵੀ ਤੰਦਰੁਸਤ ਤੰਦਰੁਸਤ ਰਹਿੰਦਾ ਹੈ ਜਿਸ ਕਾਰਣ ਮਿੱਟੀ ਵਿੱਚ ਕੰਮ ਕਰਨ ਨਾਲ ਸਰੀਰ ਨੂੰ ਕਈ ਤਰ੍ਹਾ ਦਾ ਫ਼ਾਇਦਾ ਹੁੰਦਾ ਹੈ ਅਤੇ ਮਿੱਟੀ ਵਿੱਚ ਕੰਮ ਕਰਨ ਨਾਲ ਕਰਨ ਨਾਲ ਸਵੇ ਸਵੇਰ ਦੀ ਤਾਜ਼ੀ ਹਵਾ ਵੀ ਸਾਡੇ ਸਰੀਰ ਲਈ ਫਾਇਦੇਮੰਦ ਹੁੰਦੀ ਹੈ ਜੋ ਕਿ ਫਾਮ ਫਾਰਮ ਵਿੱਚ ਹੁੰਦੀ ਹੈ ਅਤੇ